ਟਰੈਕਿੰਗ ਨਾਲ ਓਵਰਆਲ ਬੋਡੀ ਦੀ ਡੈਵਲਪਮੈਂਟ ਬਹੁਤ ਵਧੀਆ ਹੁੰਦੀ ਹੈ ਇਸਨੇ ਮੈਨੂੰ ਟਰੈ ਰਨਿੰਗ ਕਰਨ ਲਈ ਪ੍ਰੇਰਿਤ ਕੀਤਾ ਜਦੋਂ ਮੈਂ ਦੌੜਦਾ ਹਾਂ ਤਾਂ ਪੰਜ ਕਿਲੋਮੀਟਰ ਬੱਤੀ ਮਿੰਟਾਂ ਦੇ ਵਿੱਚ ਦਸ ਕਿਲੋਮੀਟਰ ਛਿਆਹਠ ਮਿੰਟਾਂ ਦੇ ਵਿੱਚ ਕਰਦਾ ਹਾਂ ਅਗਲੇ ਮਹੀਨੇ ਮੈਂ ਦਸ ਕਿਲੋਮੀਟਰ ਰਨਿੰਗ ਕਰਨ ਲਈ ਦਿੱਲੀ ਵੀ ਜਾ ਰਿਹਾ ਹਾਂ ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਆਪਦਾ ਉੱਥੇ ਬੈਸਟ ਦੇਵਾਂ